ਹਾਂਜੀ ਮੈਂ ਜਾਣਦਾ ਹਾਂ ਸ਼ੇਅਰ ਮਾਰਕੀਟ ਬਾਰੇ ਈਵਨ ਮੈਂ ਵੀ ਇਨਵੈਸਟ ਕੀਤਾ ਹੋਇਆ ਪੈਸਾ ਆਪਣੇ ਮਿਉਚੁਅਲ ਫੰਡ ਵਿੱਚ ਕਿਉਂਕਿ ਮੈਂ ਸੁਣਿਆ ਸੀ ਮਿਉਚੁਅਲ ਫੰਡ ਅਗਰ ਅਸੀਂ ਲੌਂਗ ਟਰਮ ਲਈ ਇਨਵੈਸਟ ਕਰਦੇ ਹਾਂ ਸੌ ਇਹਦੀ ਅੱਛੀ ਰਿਟਰਨ ਮਿਲਦੀ ਹੈ ਬੱਟ ਸ਼ੇਅਰ ਮਾਰਕੀਟ 'ਚ ਥੋੜ੍ਹਾ ਰਿਸਕ ਹੁੰਦਾ ਹੈ ਸੌ ਉਤਾਰ ਚੜ੍ਹਾਅ ਹੁੰਦਾ ਹੈ ਜਿੱਦਾਂ ਮਾਰਕੀਟ ਵਿੱਚ ਜੋ ਕੰਪਨੀਆਂ ਦੀ ਵੈਲਿਊ ਉੱਪਰ ਜਾ ਰਹੀ ਹੈ ਜਾਂ ਨੀਚੇ ਜਾ ਰਹੀ ਹੈ ਸੌ ਮੈਂ ਤਾਂ ਇਹੀ ਸਲਾਹ ਦੇਵਾਂਗਾ ਜਿਹਨੇ ਇਨਵੈਸਟਮੈਂਟ ਕਰਨਾ ਉਹ ਪੂਰਾ ਸੋਚ ਸਮਝ ਕੇ ਸਟੱਡੀ ਕਰਕੇ ਪੈਸੇ ਇਨਵੈਸਟ ਕਰਨ ਅਤੇ ਬਾਕੀ ਡਿਜ਼ੀਟਲ ਐਪਸ ਆਈ ਥਿੰਕ ਇਹ ਇਸ ਇੱਕ ਇੱਕ ਅੱਛੀ ਸੋਚ ਹੈ ਅ ਇੰਡੀਆ ਦੇ ਬਾਰੇ ਕਿਉਂ ਬਿਕੋਸ ਇਹਦੇ ਨਾਲ ਸਾਡਾ ਟ੍ਰਾਂਜ਼ੈਕਸ਼ਨ ਸੇਫ਼ ਹੈ ਅਸੀਂ ਸੇਫਲੀ ਪੈਸਾ ਟਰਾਂਸਫਰ ਕਰ ਸਕਦੇ ਐਂ ਇੰਸਟੈਂਟ ਕਰ ਸਕਦੇ ਹੈ ਇੱਕ ਥਾਂ ਤੋਂ ਦੂਜੀ ਥਾਂ 'ਤੇ ਅਤੇ ਸਾਨੂੰ ਪੈਸੇ ਕੈਰੀ ਕਰਨ ਦੀ ਵੀ ਲੋੜ ਨਹੀਂ ਹੈ ਕਿਉਂਕਿ ਪਹਿਲਾਂ ਅਸੀਂ ਦੇਖਿਆ ਵੀ ਕਾਫੀ ਪੈਸੇ ਚੋਰੀ ਹੋ ਜਾਂਦੇ ਸੀ ਕਈ ਵਾਰ ਸਨੈਚਿੰਗ ਹੋ ਜਾਂਦੀ ਸੀ ਬੱਟ ਹੁਣ ਅਸੀਂ ਘਰ ਬੈਠੇ ਬੈਠੇ ਈਵਨ ਸਾਨੂੰ ਬੈਂਕਿੰਗ ਜਾਣ ਦੀ ਬੈਂਕ ਵੀ ਜਾਣ ਦੀ ਲੋੜ ਨਹੀਂ ਹੈ ਅਸੀਂ ਬੈਠੇ ਹੀ ਆਪਣਾ ਪੈਸਾ ਟ੍ਰਾਂਸਫਰ ਕਰ ਸਕਦੇ ਹਾਂ ਸੌ ਇਹ ਇੱਕ ਪੋਜਟਿਵ ਮੈਂ ਤਾਂ ਇਹ ਕਵਾਂਗਾ ਇੱਕ ਪੋਜਟਿਵ ਬਲਾ ਬਦਲਾਅ ਹੈ ਅਤੇ ਅਤੇ ਇਹਦੇ ਨਾਲ ਸਾਡਾ ਟਾਇਮ ਵੀ ਸੇਵ ਹੋ ਜਾਂਦਾ ਹੈ